ਅਸੀਂ ਵਿਆਹ ਵਿੱਚ ਪੈਲਿਸ ਵਿੱਚ ਜਾਂਦੇ ਹੈ ਅਤੇ ਉੱਥੇ ਡਾਂਸ ਫਲੋਰ 'ਤੇ ਸਭ ਆਪਣੇ ਮਨਪਸੰਦ ਸੌਂਗ ਗਾਣੇ ਲਗਵਾਉਂਦੇ ਨੇ ਡੀ ਜੇ ਵਾਲੇ ਤੋਂ ਅਤੇ ਫਿਰ ਉਹ ਉੱਥੇ ਫਲੋਰ 'ਤੇ ਡਾਂਸ ਕਰਦੇ ਨੇ ਅੱਜ ਕੱਲ੍ਹ ਦੀਆਂ ਨਿਊ ਸੌਂਗਾਂ ਜਿਤਨੇ ਜਿੰਨੀਆਂ ਵੀ ਆਉਂਦੇ ਨੇ ਉਹਨਾਂ 'ਤੇ ਹੀ ਜ਼ਿਆਦਾ ਡਾਂਸ ਕਰਿਆ ਜਾਂਦਾ ਹੈ ਜਿਵੇਂ ਕਿ ਜੱਸ ਮਾਨਕ ਦਾ ਲਹਿੰਗਾ ਸੌਂਗ ਅਤੇ ਨੇਹਾ ਕੱਕੜ ਦਾ ਬਹੁਤ ਸਾਰੇ ਸੌਂਗ ਨੇ ਕਾਲਾ ਚਸ਼ਮਾ ਗੱਡੀ ਤੇਰੀ ਕਾਲੀ ਔਰ ਹਨੀ ਸਿੰਘ ਦੇ ਸੌਂਗ ਔਰ ਬਾਦਸ਼ਾਹ ਦੇ ਸੌਂਗ ਡੀ ਜੇ ਵਾਲੇ ਬਾਬੂ ਮੇਰਾ ਗਾਣਾ ਬਜਾ ਦੇ ਆਦਿ ਸੌਂਗਾਂ ਨੇ ਜਿਸ ਵਿੱਚ ਸਭ ਖੁਸ਼ ਹੋ ਕੇ ਆਪਣੀ ਮਨਪਸੰਦ ਦੀ ਦਾਰ ਸੌਂਗਾਂ 'ਤੇ ਨਾਚ ਡਾਂਸ ਕਰਕੇ ਖੁਸ਼ੀ ਮਹਿਸੂਸ ਕਰਦੀਆਂ ਨੇ ਅਤੇ ਉਹਨਾਂ ਗਾਣੇ ਨੂੰ ਉਹ ਉਹਨਾਂ ਉਸ ਵੇਲੇ ਉਹ ਆਪਣੇ ਵੀਡਿਓ ਵੀ ਬਣਵਾਉਂਦੇ ਅਤੇ ਉਹ ਉਸ ਗਾਣੇ ਦਾ ਉਸ ਟਾਈਮ ਬਹੁਤ ਜ਼ਿਆਦਾ ਹੀ ਟ੍ਰੈਡ ਹੁੰਦਾ ਹੈ